ਹੈਲੋ ਤੁਸੀਂ ਸ਼ੀਤਲ ਬੋਲਦੇ ਪਏ ਹੋ ਜੀ ਮੈਂ ਮਮਤਾ ਬੋਲਦੀ ਪਈ ਹਾਂ ਨਮਸਤੇ ਸ਼ੀਤਲ ਜੀ ਮੈਂ ਨਾ ਸੂਟ ਸਵਾਉਣਾ ਹੈ ਤੁਹਾਡੇ ਕੋਲੋਂ ਹਾਂਜੀ ਮੈਨ ਮੇਰੀ ਭੈਣ ਦੀ ਕੁੜੀ ਆਈ ਉਹਨੇ ਤੁਹਾਡੇ ਕੋਲੋਂ ਸਵਾਇਆ ਸੀ ਉਹਨੂੰ ਸੂਟ ਬੜਾ ਹੀ ਪਸੰਦ ਆਇਆ ਸੀ ਤੇ ਉਹ ਮੈਂ ਵੀ ਕਹਿਣ ਦਿੰਨੀ ਆ ਕਿ ਚਲੋ ਮੈਂ ਤੁਹਾਡੇ ਕੋਲੋਂ ਸਵਾ ਲੈਂਦੀ ਹਾਂ ਸੂਟ ਅਤੇ ਫਿਰ ਨਾਪ ਵੀ ਲਿਖ ਲਓ ਮੇਰਾ ਅਤੇ ਸੂਟ ਫਿਰ ਮੈਂ ਭੇਜ ਦੇਵਾਂਗੀ ਹਾਂਜੀ ਲਿਖੋ ਲੰਬਾਈ ਤਿਰਤਾਲੀ ਛਾਤੀ ਬੱਤੀ ਕਮਰ ਅਠਾਈ ਹਿੱਪ ਅਠਾਰਾਂ ਘੇਰਾ ਵੀ ਅਠਾਰਾਂ ਸਲਵਾਰ ਛੱਤੀ ਬਾਜੂ ਚੌਦਾਂ ਹਾਂਜੀ ਤੁਹਾਡਾ ਨਾ ਸੂਟ ਮੈਨੂੰ ਬੜਾ ਹੀ ਪਸੰਦ ਆਇਆ ਸੀ ਜਿਹੜਾ ਭੈਣ ਦੀ ਕੁੜੀ ਦਾ ਸੀਤਾ ਸੀ ਵਧੀਆ ਕਰਕੇ ਸੀਓ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਮੈਂ ਅੱਗੇ ਵੀ ਗੱਲ ਕਰਦੀ ਪਈ ਸੀ ਸ਼ੀਤਲ ਕੱਪੜੇ ਸੋਹਣੇ ਸਿਊਂਦੀ ਆ ਤੇ ਸ਼ੀਤਲ ਕੋਲੋਂ ਸਵਾ ਲਵਾਂਗੇ ਮੈਂ ਆਪਣੀ ਗਵਾਂਢਣ ਨੂੰ ਵੀ ਕਹਿ ਰਹੀ ਸੀ ਮੈਂ ਕਿਹਾ ਮੈਂ ਕਿਹਾ ਮੈਂ ਕਿਹਾ ਸ਼ੀਤਲ ਕੋਲੋਂ ਸਵਾ ਲੈਂਦੇ ਹਾਂ ਸੂਟ ਸ਼ੀਤਲ ਵਧੀਆ ਕੱਪੜੇ ਸਿਊਂਦੀ ਹੈ ਕਹਿੰਦੀ ਕੋਈ ਨਹੀਂ ਚੱਲ ਤੂੰ ਸੁਆ ਕੇ ਦੇਖ ਲੈ ਅਤੇ ਬਾਅਦ ਵਿੱਚ ਮੈਂ ਸਵਾ ਲਵਾਂਗੀ ਅਤੇ ਹੁਣ ਫਿਰ ਮੈਂ ਭੇਜ ਦੇਵਾਂਗੀ ਸੂਟ ਠੀਕ ਹੈ ਹਾਂਜੀ ਹਾਂਜੀ ਔਰ ਠੀਕ ਹੈ ਦੀਦੀ ਠੀਕ ਹੈ ਜੀ